ਅਸੀਂ ਆਪਣੇ ਪੌਦਿਆਂ ਦੀ ਸਿਹਤ ਦਾ ਧਿਆਨ ਰੱਖਣ ਲਈ ਉਸ ਨੂੰ ਬਹੁਤ ਹੀ ਸੰਭਾਲ ਕੇ ਰੱਖਦੇ ਹਾਂ ਉਸ ਦੀ ਗੋਡੀ ਵਗੈਰਾ ਦਵਾਈ ਜੋ ਵੀ ਹੈ ਉਸਨੂੰ ਇਸ ਤਰ੍ਹਾਂ ਦੇਖਭਾਲ ਕਰਦੇ ਹਾਂ ਪਾਣੀ ਵੀ ਟੈਮ ਸਿਰ ਦਿੰਦੇ ਹਾਂ ਫਿਰ ਉਸ ਨੂੰ ਜੋ ਵੀ ਕੋਈ ਬਿਮਾਰੀ ਜਾਂ ਕੁਛ ਵੀ ਹੋ ਜਾਵੇ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਘਰ ਦੇ ਬਜ਼ੁਰਗਾਂ ਨੂੰ ਪੁੱਛਦੇ ਹਾਂ ਕਿਉਂਕਿ ਉਹਨਾਂ ਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਹੈ ਉਹਨਾਂ ਨੂੰ ਜੋ ਵੀ ਪਤਾ ਹੈ ਉਹ ਦੱਸਦੇ ਨੇ ਜਾਂ ਅਸੀਂ ਗੂਗਲ ਤੋਂ ਸਰਚ ਕਰਕੇ ਅਸੀਂ ਉਸ ਦਿਨ ਉਸ ਬਾਰੇ ਪੌਦਿਆਂ ਬਾਰੇ ਪੁੱਛਦੇ ਹਾਂ ਜਾਣਕਾਰੀ ਲੈਂਦੇ ਹਾਂ ਜਾਂ ਅਸੀਂ ਯੂਟਿਊਬ ਤੋਂ ਪੌਦਿਆਂ ਦੀ ਜਾਣਕਾਰੀ ਲੈਂਦੇ ਹਾਂ ਇਸ ਤਰ੍ਹਾਂ ਅਸੀਂ ਆਪਣੇ ਪੌਦਿਆਂ ਦੀ ਜੋ ਵੀ ਬਿਮਾਰੀ ਹੋਵੇ ਉਹਦੀ ਦੇਖਭਾਲ ਕਰਦੇ ਹਾਂ ਸਹੀ ਤਰ੍ਹਾਂ ਉਹਨਾਂ ਨੂੰ ਵੇਖਦੇ ਹਾਂ ਇਸ ਤਰ੍ਹਾਂ ਸਾਡੇ ਪੌਦੇ ਵਧੀਆ ਤਰ੍ਹਾਂ ਰਹਿੰਦੇ ਨੇ ਅਤੇ ਸੋਹਣੇ ਲੱਗਦੇ ਨੇ